ਕੱਲ ਮੈਂ ਆਪਣੇ ਕਾਲਜ ਜਦ ਗਈ ਤਾਂ ਕਾਲਜ ਜਾਣ ਲਈ ਮੈਂ ਇੱਕ ਕੈਬ ਬੁੱਕ ਕਰਵਾਈ ਅਤੇ ਕੈਬ ਵਿੱਚ ਜਦੋਂ ਮੈਂ ਕੈਬ ਤੋਂ ਕਾਲਜ ਜਾ ਕੇ ਉੱਤਰੀ ਤਾਂ ਦੇਖਿਆ ਕਿ ਮੇਰਾ ਪਰਸ ਮੇਰੇ ਕੋਲ ਨਹੀਂ ਹੈ ਜਦ ਮੈਂ ਵੇਖਿਆ ਤਾਂ ਉਹ ਕੈਬ ਵਾਲਾ ਵੀ ਚੱਲ ਗਿਆ ਸੀ ਫਿਰ ਮੈਂ ਨੈੱਟ 'ਤੇ ਜਾ ਕੇ ਉਸ ਕੈਬ ਵਾਲੇ ਦਾ ਨੰਬਰ ਸਰਚ ਕੀਤਾ ਫਿਰ ਉਹਨਾਂ ਨੇ ਦੇਖਿਆ ਕਿ ਫਿਰ ਮੈਂ ਉਸ ਕੈਬ ਵਾਲੇ ਦਾ ਨੰਬਰ ਲਿਆ ਅਤੇ ਕੈਬ ਵਾਲੇ ਨੂੰ ਕਾਲ ਕੀਤੀ ਕਾਲ ਕਰਕੇ ਉਸ ਡਰਾਈਵਰ ਮੇਰੇ ਕੋਲ ਆ ਗਿਆ ਤਾਂ ਡਰਾਈਵਰ ਨੇ ਮੇਰਾ ਪਰਸ ਦਿੱਤਾ ਅਤੇ ਮੈਂ ਉਹਦਾ ਬਹੁਤ ਦਿਲੋਂ ਧੰਨਵਾਦ ਕੀਤਾ ਅਤੇ ਉਹ ਮੇਰਾ ਪਰਸ ਦੇ ਕੇ ਵਾਪਸ ਚਲਾ ਗਿਆ